ਇੱਕ ਕਲਾਕਾਰ ਦੇ ਰੂਪ ਵਿੱਚ ਮੈਨੂੰ ਕਾਫ਼ੀ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਦੂਰ ਦਾ ਸਫ਼ਰ ਸੀਗਾ ਮੈਨੂੰ ਜਾਣ ਆਉਣ ਵਿੱਚ ਬਹੁਤ ਪ੍ਰੋਬਲਮਸ ਹੁੰਦੀਆਂ ਸੀਗੀਆਂ ਲੇਟ ਪਹੁੰਚਣਾ ਹੈ ਨਾ ਉੱਥੇ ਮੇਰਾ ਕੋਂਪੀਟੀਸ਼ਨ ਸੀਗਾ ਡਰਾਇੰਗ ਦਾ ਏਰੀਏ 'ਚ ਅਤੇ ਫਿਰ ਮੈਨੂੰ ਆਉਣ ਜਾਣ 'ਚ ਬਹੁਤ ਮੁਸ਼ਕਿਲ ਸੀਗੀ ਫਿਰ ਮੈਂ ਐਕਟੀਵਾ ਲਈ ਅਤੇ ਮੈਨੂੰ ਕਾਫ਼ੀ ਸੁਖਾਲਾ ਹੋ ਗਿਆ ਅਤੇ ਇਸ ਤਰ੍ਹਾਂ ਮੈਂ ਆਪਣਾ ਪੇਂਟਿੰਗ ਡਰਾਇੰਗ ਕੋਂਪਟੀਸ਼ਨ ਕੰਪਲੀਟ ਕੀਤਾ ਅਤੇ ਅਸੀਂ ਸ਼ਹਿਰ ਤੋਂ ਕਾਫ਼ੀ ਦੂਰ ਵੀ ਹਾਂ ਸਾਡੇ ਪਿੰਡਾਂ ਜਗ੍ਹਾਂ 'ਤੇ ਦੁਕਾਨਾਂ ਤਾਂ ਕਾਫ਼ੀ ਨੇ ਪਰ ਸਟੇਸ਼ਨਰੀ ਦਾ ਸਮਾਨ ਬਹੁਤ ਮੁਸ਼ਕਿਲ ਨਾਲ ਮਿਲਦਾ ਬਹੁਤ ਸਾਰੀ ਕਮੀ ਹੁੰਦੀ ਹੈ ਕਿਉਂਕਿ ਸਾਨੂੰ ਜੋ ਵੀ ਸਮਾਨ ਚਾਹੀਦਾ ਉਹ ਪੂਰਾ ਕੰਪਲੀਟ ਨਹੀਂ ਮਿਲਦਾ ਅਤੇ ਇਸ ਲਈ ਮੈਨੂੰ ਜਾਣ ਆਉਣ 'ਚ ਵੀ ਪ੍ਰੋਬਲਮ ਸੀ ਅਤੇ ਮੈਨੂੰ ਸਟੇਸ਼ਨਰੀ ਦੀ ਤਾਂ ਕਾਫ਼ੀ ਸਾਰੀ ਪ੍ਰੋਬਲਮਸ ਸੀਗੀ ਫਿਰ ਮੈਂ ਸ਼ਹਿਰ ਜਾ ਕੇ ਐਕਟੀਵਾ 'ਤੇ ਇਕੱਠਾ ਹੀ ਸਮਾਨ ਲੈ ਕੇ ਆਉਣਾ ਸਟਾਰਟ ਕਰਤਾ ਫਿਰ ਉਸ ਕਾਰਨ ਮੈਨੂੰ ਕਾਫ਼ੀ ਸਾਰਾ ਸੁਖਾਲਾ ਹੋ ਗਿਆ ਅਤੇ ਮੈਨੂੰ ਹੁਣ ਕੋਈ ਵੀ ਪ੍ਰੋਬਲਮ ਨਹੀਂ ਹੈ ਮੈਂ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰ ਚੁੱਕੀ ਸੀ ਹੁਣ ਬਿਲਕੁਲ ਵਧੀਆ ਹੈ